ਹਾਂਜੀ ਮੈਂ ਨਾ ਸ ਬੁਣਾਈ ਬਾਰੇ ਥੋੜ੍ਹਾ ਬਹੁਤ ਮੈਨੂੰ ਜਾਣਕਾਰੀ ਹੈਗੀ ਹੈ ਕਿਉਂਕਿ ਮੈਂ ਪਹਿਲੇ ਕਰਦੀ ਸੀ ਵਿਆਹ ਤੋਂ ਪਹਿਲਾ ਥੋੜ੍ਹੀ ਬਹੁਤ ਸਿੱਖੀ ਸੀਗੀ ਪਰ ਮੈਂ ਉਸ ਤੋਂ ਬਾਅਦ ਇਹਨੂੰ ਕੀਤਾ ਨਹੀਂ ਵਿਆਹ ਤੋਂ ਬਾਅਦ ਅਤੇ ਮੈਂ ਥੋੜ੍ਹਾ ਜਿਹਾ ਬੱਚਾ ਬੱਚੇ ਹੋ ਗਏ ਇਹਦੇ ਨਾਲ ਅਸੀਂ ਬਿਜ਼ੀ ਹੋ ਗਏ ਤਾਂ ਅਸੀਂ ਕੀਤਾ ਨਹੀਂ ਉਸ ਤੋਂ ਬਾਅਦ ਮੈਨੂੰ ਹੁਣ ਥੋੜ੍ਹਾ ਮੈਂ ਸ਼ੁਰੂ ਕੀਤੀ ਹੈ ਕਿ ਥੋੜ੍ਹੀ ਬਹੁਤ ਸਿੱਖਦੀ ਪਈ ਹਾਂ ਜਿਸ ਤਰ੍ਹਾਂ ਥੋੜ੍ਹੀ ਬਹੁਤ ਬੁਣਾਈ ਕਿੱਦਾਂ ਕਰੀਦੀ ਹੈ ਔਰ ਸਿਲਾਈ ਵੀ ਥੋੜ੍ਹੇ ਥੋੜ੍ਹੇ ਜਿਸ ਤਰ੍ਹਾਂ ਮੈਂ ਘਰ ਦੇ ਕਦੀ ਬੱਚਿਆਂ ਦੇ ਰੁਮਾਲ ਬਣਾ ਦਿੱਤੇ ਨਿੱਕਰਾਂ ਬਣਾ ਲਈਆਂ ਛੋਟੇ ਛੋਟੇ ਕੰਮ ਮੈਂ ਸ਼ੁਰੂ ਕੀਤੇ ਹੈ ਆਪਣੀ ਫਿਰ ਸਹੇਲੀ ਦੇ ਨਾਲ ਮਿਲ ਕੇ ਨਾ ਥੋੜ੍ਹਾ ਉਹਨੂੰ ਉਹ ਪੂਰੀ ਮਤਲਬ ਉਹਨੂੰ ਜਾਣਕਾਰੀ ਹੈ ਉਹ ਮੈਂ ਉਹਦੀ ਮਦਦ ਨਾਲ ਥੋੜ੍ਹਾ ਬਹੁਤ ਸਿੱਖਣਾ ਸ਼ੁਰੂ ਕੀਤਾ ਹੈ ਤਾਂ ਕਿ ਅੱਗੇ ਜਾ ਕੇ ਮੈਂ ਥੋੜ੍ਹਾ ਹੋਰ ਇਹ ਕੰਮ ਵਧਾ ਸਕਾਂ ਅਤੇ ਇਹਦੇ ਵਿੱਚ ਇਹ ਜ਼ਰੂਰੀ ਵੀ ਹੈ ਅਗਰ ਸਾਨੂੰ ਇਹ ਚੀਜਾਂ ਆਉਂਦੀਆਂ ਨੇ ਸਾਡੇ 'ਚ ਅਗਰ ਇਹ ਦੀ ਕਲਾ ਹੈਗੀ ਹੈ ਤਾਂ ਅਸੀਂ ਅੱਗੇ ਜਾ ਕੇ ਕੁਛ ਵੀ ਕਰ ਸਕਦੇ ਹਾਂ ਇਹਦੇ ਵਿੱਚ ਅਸੀਂ ਆਪਣੀ ਇਨਕਮ ਸੋਰਸ ਵੀ ਕਰ ਸਕਦੇ ਹਾਂ ਅਸੀਂ ਮਤਲਬ ਘਰ ਦਿਆਂ ਵੀ ਕੰਮ ਵੀ ਸਾਨੂੰ ਬਾਹਰ ਦੇਣ ਦੀ ਲੋੜ ਨਹੀਂ ਪਵੇਗੀ ਅਸੀਂ ਉਨ੍ਹਾਂ ਦੇ ਪੈਸੇ ਬਚਾ ਸਕਦੇ ਹਾਂ ਮੈਂ ਆਪਣੇ ਸੂਟ ਅਗਰ ਮੰਨ ਲਓ ਮੈਨੂੰ ਸਿਲਾਈ ਆਉਂਦੀ ਹੈ ਤਾਂ ਮੈਂ ਆਪਣੇ ਸੂਟ ਆਪ ਸਿਓਂ ਸਕਦੀ ਹਾਂ ਛੋਟੇ ਮੋਟੇ ਕੱਪੜੇ ਚਾਦਰਾਂ ਕੋਈ ਰੁਮਾਲੇ ਕੋਈ ਕੁਛ ਮੈਂ ਆਪ ਬਣਾ ਸਕਦੀ ਹਾਂ ਘਰ ਵਿੱਚ ਅਤੇ ਇਹਦੀ ਵੈਸੇ ਬਹੁਤ ਮਹੱਤਤਾ ਹੈ ਸਾਨੂੰ ਸਿੱਖਣਾ ਚਾਹੀਦਾ ਜੀਵਨ ਵਿੱਚ ਅੱਗੇ ਜਾ ਕੇ ਬਹੁਤ ਜ਼ਰੂਰੀ ਹੈ ਔਰ ਮੈਂ ਅੱਗੋਂ ਹੋਰ ਕੋਸ਼ਿਸ਼ ਕਰਾਂਗੀ ਕਿ ਮੈਂ ਹੋਰ ਜ਼ਿਆਦਾ ਇਹ ਦੀ ਜਾਣਕਾਰੀ ਲਵਾਂ ਔਰ ਮੈਂ ਆਪਣੇ ਪੂਰੀ ਇਹ ਦੇ ਕਾਬਿਲ ਹੋਵਾਂ ਤਾਂ ਕਿ ਮੈਂ ਅੱਗੇ ਜਾ ਕੇ ਆਪਣਾ ਕੰਮ ਵੀ ਸ਼ੁਰੂ ਕਰ ਸਕਾਂ ਭਵਿੱਖ ਵਿੱਚ ਬਸ ਇਹਦੇ ਵਾਲੀ ਅਤੇ ਬਹੁਤ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੁੰਦੀ ਹੈ ਚਲੋ ਉਹ ਕਰਨੀ ਚਾਹੀਦੀ ਅਗਰ ਮਿਹਨਤ ਕਰਾਂਗੇ ਤਾਂ ਹੀ ਸਾਨੂੰ ਫਲ ਮਿਲੇਗਾ ਚਲੋ ਮੈਂ ਮਿਹਨਤ ਕਰਾਂਗੀ ਅੱਗੋਂ ਜਾ ਕੇ ਪਰ ਮੈਂ ਮੇਰੇ ਵੱਲੋਂ ਤਾਂ ਇਹ ਮੈਂ ਕਹਿ ਰਹੀ ਹਾਂ ਕਿ ਇਹਹ ਬਹੁਤ ਹੀ ਜ਼ਰੂਰੀ ਹੈ ਸਿਲਾਈ ਵੀ ਅਗਰ ਅਸੀਂ ਬਾਹਰ ਦੇ ਨਹੀਂ ਕਿਸੇ ਦੇ ਕੰਮ ਕਰਦੇ ਲੇਕਿਨ ਘਰ ਦਾ ਤਾਂ ਅਸੀਂ ਕਰਕੇ ਆਪਣੇ ਪੈਸੇ ਤਾਂ ਬਚਾ ਸਕਦੇ ਹਾਂ ਨਾਂ ਅਤੇ ਇਹ ਤਾਂ ਬਹੁਤ ਜ਼ਰੂਰੀ ਹੈ ਬਾਕੀ ਸਿਲਾਈ ਦੇ ਬੁਣਾਈ ਹੁੰਦੀ ਹੈ ਉਹਦੇ ਵਿੱਚ ਵੀ ਜ਼ਰੂਰੀ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਸੂਐਟਰ ਬਣਾ ਸਕਦੇ ਹਾਂ ਛੋਟੇ ਛੋਟੇ ਮਤਲਬ ਮੋਜੇ ਬਣਾ ਸਕਦੇ ਹਾਂ ਕੁਛ ਵੀ ਕਰੋਸ਼ੀਆ ਚਲਾ ਸਕਦੇ ਹਾਂ ਕਰੋਸ਼ੀਏ ਦੇ ਕੱਪੜੇ ਬੜੇ ਅੱਜ ਕੱਲ੍ਹ ਲੋਕ ਪਸੰਦ ਕਰਦੇ ਹੈ ਉਨ੍ਹਾਂ ਦਾ ਡਿਜ਼ਾਈਨ ਬਾਹਰ ਤੱਕ ਪਹੁੰਚਦਾ ਹੈ ਕਰੋਸ਼ੀਆ ਦਾ ਇੰਨਾ ਜ਼ਿਆਦਾ ਮਤਲਬ ਰਿਵਾਜ਼ ਆ ਗਿਆ ਹੈ ਕਿ ਕਰੋਸ਼ੀਆ ਨੂੰ ਅਸੀਂ ਬਹੁਤ ਜ਼ਿਆਦਾ ਲੋਕ ਉਨ੍ਹਾਂ ਦੀਆਂ ਨਾ ਔਰਤਾਂ ਬਹੁਤ ਉਨ੍ਹਾਂ ਦੀ ਕੋਟੀਆਂ ਪਸੰਦ ਕਰਦੀਆਂ ਨੇ ਕਰੋਸ਼ੀਏ ਦੀਆਂ ਹਾਫ ਜੈਕਟਾਂ ਕੋਟੀਆਂ ਬੱਚਿਆਂ ਦੇ ਨਵੇਂ ਨਵੇਂ ਸਵੈਟਰ ਫਰਾਕਾਂ ਕੁੜੀਆਂ ਦੀਆਂ ਇਹ ਕਰੋਸ਼ੀਏ ਨਾਲ ਬਹੁਤ ਵਧੀਆ ਲੱਗਦੀਆਂ ਨੇ ਬਸ ਮੈਨੂੰ ਮੈਂ ਅੱਗੇ ਜਾ ਕੇ ਕੋਸ਼ਿਸ਼ ਕਰਾਂਗੀ ਕਿ ਮੈਂ ਹੋਰ ਅੱਗੇ ਇਹ ਇਹਦੀ ਜਾਣਕਾਰੀ ਲਵਾਂ ਤਾਂ ਕਿ ਮੈਂ ਮੈਨੂੰ ਇਹਦੇ ਵਿੱਚ ਫ਼ਾਇਦਾ ਹੋ ਸਕੇ ਔਰ ਹਰ ਔਰਤ ਨੂੰ ਹੈ ਚੀਜ਼ ਆਉਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਕਾਬਿਲ ਕੁਛ ਕਰ ਸਕੇ ਹੂੰ